ਮੇਰੇ ਘਰ ਵਿੱਚ ਇੱਕ ਬਹੁਤ ਹੀ ਜ਼ਿਆਦਾ ਵੱਡਾ ਪਾਰਕ ਹੈ ਉੱਥੇ ਰੋਜ਼ਾਨਾ ਦੇ ਤੌਰ 'ਤੇ ਕਾਫੀ ਸਾਰੇ ਕਬੂਤਰ ਅਤੇ ਚਿੜੀਆਂ ਬੈਠਦੀਆਂ ਹਨ ਉੱਥੇ ਮੈਂ ਉਹਨਾਂ ਨੂੰ ਚੋਗਾ ਅਤੇ ਪਾਣੀ ਪਾਉਂਦਾ ਹਾਂ ਵੀ ਕਿਉਂਕਿ ਇਸ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਅਤੇ ਇਹ ਮੈਂ ਆਪਣਾ ਇੱਕ ਫਰਜ਼ ਸਮਝਦਾ ਹਾਂ ਉਹਨਾਂ ਨੂੰ ਪਾਣੀ ਪਿਆਉਣਾ ਅਤੇ ਖਾਣਾ ਖਵਾਉਣਾ